ਮੇਰੇ ਦਾਦਾ ਦਾਦੀ ਬਿਲਕੁਲ ਵੀ ਨਹੀਂ ਪੜ੍ਹੇ ਲਿਖੇ ਔਰ ਉਹਨਾਂ ਨੇ ਮੇਰੇ ਮਾਤਾ ਪਿਤਾ ਨੂੰ ਕੁਝ ਤੱਕ ਹੱਦ ਤੱਕ ਪੜ੍ਹਾਇਆ ਹੈ ਅਤੇ ਉਹ ਬਹੁਤ ਹੀ ਮਾੜੇ ਸਮੇਂ ਵਿੱਚੋਂ ਉੱਠ ਕੇ ਹੁਣ ਪਹੁੰਚੇ ਹਨ ਤਾਂ ਜੋ ਸਾਨੂੰ ਮਹਿੰਗੇ ਸਕੂਲਾਂ ਵਿੱਚ ਪੜ੍ਹਾ ਰਹੇ ਹਨ ਮੈਂ ਉਹਨਾਂ ਦੀ ਮਿਹਨਤ ਨੂੰ ਸਫ਼ਲ ਕਰਨਾ ਚਾਹੁੰਦਾ ਹਾਂ ਅਤੇ ਵੱਡਾ ਹੋ ਕੇ ਸਰਕਾਰੀ ਪ੍ਰਿੰਸੀਪਲ ਲੱਗਣਾ ਚਾਹੁੰਦਾ ਹਾਂ ਅਤੇ ਮੈਂ ਬੀ ਕੌਮ ਅਤੇ ਪੀ ਐੱਚ ਡੀ ਕਰਨਾ ਚਾਹੁੰਦਾ ਹਾਂ ਇਸ ਲਈ ਮੈਂ ਬਹੁਤ ਮਿਹਨਤ ਕਰ ਰਿਹਾ ਹਾਂ ਮੈਂ ਦਿਨ ਰਾਤ ਲਾ ਇੱਕ ਕਰਕੇ ਪੜ੍ਹ ਰਿਹਾ ਹਾਂ ਉਹਨਾਂ ਨੇ ਮੇਰੀ ਪੜ੍ਹਾਈ ਦੇ ਲਈ ਕੋਈ ਕਸਰ ਨਹੀਂ ਛੱਡੀ ਮੇਰੇ ਲਈ ਉਹਨਾਂ ਨੇ ਘਰ ਵਿੱਚ ਇਨਵੇਟਰ ਵੀ ਲਗਾ ਦਿੱਤਾ ਕਿ ਜੇ ਬੱਤੀ ਜਾਵੇ ਤਾਂ ਮੈਨੂੰ ਕੋਈ ਦਿੱਕਤ ਨਾ ਆਵੇ ਮੇਰੇ ਲਈ ਵੱਖਰਾ ਕਮਰਾ ਵੀ ਬਣਾ ਦਿੱਤਾ ਅਤੇ ਸਟੱਡੀ ਟੇਬਲ ਵੀ ਲਿਆ ਦਿੱਤਾ ਅਤੇ ਮੇਰੇ ਕਮਰੇ ਵਿੱਚ ਏ ਸੀ ਵੀ ਲਗਵਾ ਦਿੱਤਾ ਇਸ ਲਈ ਮੈਂ ਆਪਣੀ ਮਿਹਨਤ ਸਦਕਾ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦਾ ਹਾਂ ਅਤੇ ਉਹਨਾਂ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹਾਂ ਤਾਂ ਜੋ ਅੱਗੇ ਜਾ ਕੇ ਸਾਰੇ ਉਹਨਾਂ ਨੂੰ ਚੰਗਾ ਕਹਿ ਸਕਣ ਕਿ ਤੁਹਾਡਾ ਮੁੰਡਾ ਬਹੁਤ ਲਾਇਕ ਨਿਕਲਿਆ ਹੈ ਅਤੇ ਮੈਂ ਉਹਨਾਂ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹਾਂ ਅਤੇ ਉਹਨਾਂ ਨੂੰ ਹੋਰ ਤੰਗੀਆਂ 'ਚੋਂ ਕੱਢ ਕੇ ਊਚ ਪੱਧਰ 'ਤੇ ਖੜ੍ਹਨਾ ਚਾਹੁੰਦਾ ਹਾਂ